ਇਹ ਤਾਂ ਪੰਜਾਬ 'ਚ ਬਹੁਤ ਸਾਰੀ ਪ੍ਰਮੁੱਖ ਭਾਸ਼ਾਏਂ ਬੋਲੀ ਜਾਂਦੀਆਂ ਹਨ ਲੇਕਿਨ ਪੰਜਾਬ 'ਚ ਪੰਜਾਬੀ ਦੀ ਭਾਸ਼ਾ ਹੈ ਜਿਸ ਨੂੰ ਪੰਜਾਬ ਦੇ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਹੀ ਬੋਲਦੇ ਹਨ ਇਹ ਭਾਸ਼ਾਵਾਂ ਦੇ ਹਿੰਦੂ ਪੂਰਵੀ ਪਰਿਵਾਰ ਵਿੱਚ ਅਤੇ ਹਿੰਦੂ ਈਰਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ ਗੁਰਮੁਖੀ ਲਿਪੀ ਅਤੇ ਇਹ ਚੀਜ਼ ਦੀਆਂ ਦੇ ਮੁੱਖ ਉਪਬੋਲੀਆਂ ਹਨ ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ ਲਹਿੰਦੀ ਪੰਜਾਬੀ ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਆਪਣੇ ਸੁਰ ਵਿਗਿਆਨ ਕਰਕੇ ਅਜੋਕੀ ਹਿੰਦੂ ਪੂਰਵੀ ਬੋਲੀ ਦੇ ਪਰਿਵਾਰ ਵਿੱਚ ਸਭ ਤੋਂ ਵੱਖਰੀ ਬੋਲੀ ਜਾਂਦੀ ਹੈ ਪੰਜਾਬ ਦੀਆਂ ਕਈ ਉਪਬੋਲੀਆਂ ਹਨ ਜਿਵੇਂ ਕਿ ਮਾਝਾ ਮਾਲਵੇ ਦੁਆਬੀ ਅਤੇ ਪੁਆਧੀ ਪੋਠੋਹਾਰੀ ਹੈਗੀ ਹੈ ਇਹ ਉਪ ਬੋਲੀ ਪੁਰਾਣੇ ਪੰਜਾਬ ਦੇ ਮਾਝਾ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ ਇਸ ਤੋਂ ਉਪ ਬੋਲੀ ਦੀ ਵਰਤੋਂ ਪੰਜਾਬ ਦੀਆਂ ਕਿਤਾਬਾਂ 'ਚ ਲਿਖੀ ਹੁੰਦੀ ਹੈ ਪੰਜਾਬ ਦੀਆਂ ਸਾਰੀ ਬੋਲੀਆਂ ਦੀ ਆਪਣੀ ਹੀ ਇੱਕ ਮਹੱਤਵ ਹੈ ਅਤੇ ਸਾਰੇ ਆਪਣੇ ਆਪਣੇ ਖੇਤਰ ਅਤੇ ਉੱਤੇ ਦੇ ਲੋਕਾਂ ਦੀ ਪਹਿਚਾਣ ਹੈ ਇਹ ਬੋਲੀਆ ਪੰਜਾਬ ਦੀ ਵੱਖ ਵੱਖ ਸੁੰਦਰਤਾ ਨੂੰ ਵਿਖਾਉਂਦੀਆਂ ਹਨ ਅਤੇ ਪੰਜਾਬ ਦੇ ਵਿਰਸੇ ਨੂੰ ਅਮੀਰ ਬਣਾਉਂਦੇ ਹਨ ਇਹ ਭਾਰਤੀ ਦੀ ਚੜ੍ਹਦਾ ਪੰਜਾਬ ਸੂਬੇ ਦੇ ਸਰਕਾਰੀ ਬੋਲੀ ਹੈ ਪੰਜਾਬੀ ਭਾਸ਼ਾ ਦੇ ਸੱਭਿਆਚਾਰ ਵਜੋਂ ਇਹ ਦੇਸ਼ਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਆਪਸ ਵਿੱਚ ਜੋੜਦੀ ਰਹਿੰਦੀ ਹੈ